ਮੋਹਾਲੀ ਜ਼ਿਲ੍ਹੇ ਵਿੱਚ ਹਰੇਕ ਤਰ੍ਹਾਂ ਦੇ ਕਾਸਟ ਹਰੇਕ ਤਰ੍ਹਾਂ ਦੇ ਧਰਮ ਦਾ ਬੰਦਾ ਰਹਿੰਦਾ ਜੀ ਬਾਹਰ ਤੋਂ ਚੱਲ ਕੇ ਆ ਕੇ ਇੱਥੇ ਕੰਮ ਕਾਜ ਲਈ ਰ ਰਹਿੰਦੇ ਹੈ ਜੀ ਲੋਕ ਹਰੇਕ ਤਰ੍ਹਾਂ ਦੀ ਭਾਸ਼ਾ ਦੇ ਜ਼ਿਆਦਾਤਰ ਪੰਜਾਬੀ ਹਿੰਦੀ ਇੰਗਲਿਸ਼ ਤਿੰਨੇ ਭਾਸ਼ਾਵਾਂ ਦੀ ਵਰਤੋਂ ਹੁੰਦੀ ਹੈ ਜੀ ਕਬੀਲਿਆਂ ਬਾਰੇ ਸਾਰਿਆਂ ਦਾ ਆਪਸ 'ਚ ਪਿਆਰ ਬਹੁਤ ਆ ਜੀ ਪਿਆਰ ਭਾਵਨਾ ਬਣੀ ਹੋਈ ਆ ਕਿ ਰਲ਼ ਕੇ ਕੰਮ ਕਰਦੇ ਆ ਸਾਰੇ ਹਰੇਕ ਵਰਗ 'ਚ ਹਰ ਤਰ੍ਹਾਂ ਦਾ ਹਰ ਜਾਤ ਦਾ ਹਰ ਧਰਮ ਦਾ ਬੰਦਾ ਹੁੰਦਾ ਜੀ ਸਾਡੇ ਜ਼ਿਲ੍ਹੇ ਵਿੱਚ ਥੋੜ੍ਹੇ ਜੇ ਅੰਤਰ ਨਾਲ ਭਾਸ਼ਾ ਵੀ ਬਦਲਦੀ ਹੈ ਜੀ ਏਰੀਏ ਦੇ ਹਿਸਾਬ ਨਾਲ ਭਾਸ਼ਾ ਬਦਲਦੀ ਹੈ ਜੀ ਸਾਡੇ ਏਰੀਏ 'ਚ ਮੋਹਾਲੀ 'ਚ